ਨਗਰ ਪਾਲਿਕਾ ਜਾਂ ਪੰਚਾਇਤ ਲੋਕਾਂ ਵੱਲੋਂ ਚੁਣੀ ਗਈ ਉਹ ਸੰਸਥਾ ਹੈ ਜੋ ਉਸ ਇਲਾਕੇ ਉਸ ਨਿਸ਼ਚਿਤ ਇਲਾਕੇ ਦੀ ਪ੍ਰਗਤੀ ਨੂੰ ਦੇਖਦੀ ਹੈ ਨਗਰ ਪਾਲਿਕਾ ਜਾਂ ਪੰਚਾਇਤ ਵਿੱਚ ਵੱਖ ਵੱਖ ਮੈਂਬਰ ਹੁੰਦੇ ਹਨ ਅਤੇ ਉਹਨਾਂ ਦੇ ਮੁਖੀ ਜੇ ਆਪਾਂ ਪੰਚਾਇਤ ਲਗਾਈਏ ਅਤੇ ਉਸ ਦਾ ਸਰਪੰਚ ਅਤੇ ਜੇ ਨਗਰਪਾਲਿਕਾ ਲਾਈਏ ਅਤੇ ਉਹਦਾ ਮੁਨਸਿਪਲ ਕਮਿਸ਼ਨ ਹੁੰਦਾ ਹੈ ਇਹਨਾਂ ਦਾ ਮੁੱਖ ਕੰਮ ਉਸ ਇਲਾਕੇ ਨੂੰ ਪ੍ਰਗਤੀਸ਼ੀਲ ਕਰਨਾ ਜਿਵੇਂ ਕਿ ਸੜਕਾਂ ਬਣਾਉਣੀਆਂ ਜੇ ਸੀਵੇਜ ਨਹੀਂ ਏ ਤਾਂ ਸੀਵੇਜ ਸਿਸਟਮ ਲਿਆਉਣਾ ਉੱਥੇ ਸਿਕਿਉਰਿਟੀ ਸਿਸਟਮ ਕੱਢਣਾ ਉੱਥੇ ਕਿਸੇ ਵੀ ਪ੍ਰਕਾਰ ਦੀ ਗੈਰ ਕਾਨੂੰਨੀ ਕੰਮ ਨਾ ਹੋਣੇ ਜਾਂ ਅਸੀ ਕਹਿ ਦਿੰਦੇ ਸਿੱਖਿਆ ਵਿ ਵਿੱਚ ਪ੍ਰਭਾਵ ਪਾਉਣਾ ਸਿੱਖਿਆ ਉੱਤੇ ਪ੍ਰਭਾਵ ਪਾਉਣਾ ਸਿੱਖਿਆ ਨੂੰ ਚੰਗਾ ਕਰਨਾ ਉੱਥੇ ਦਾ ਜਿਹੜਾ ਯੂਥ ਹੈੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਵੱਲ ਨੂੰ ਕੰਮ ਲਾਉਣਾ ਜਿਵੇਂ ਕਿ ਉਹਨਾਂ ਨੂੰ ਜਿੰਮਾਂ ਬਣਾ ਕੇ ਦੇਣੀਆਂ ਪਾਰਕਾਂ ਵਿੱਚ ਜਿੰਮਾਂ ਆਊਟਡੋਰ ਜਿੰਮਾਂ ਲਾਉਣੀਆਂ ਇਹ ਕੁਝ ਕੰਮ ਹੋ ਸਕਦੇ ਨੇ ਪਾਰਕ ਬਣਾਉਣੇ ਨਗਰ ਵਿੱਚ ਜਾਂ ਫਿਰ ਪਿੰਡਾਂ ਵਿੱਚ ਪਾਰਕ ਬਣਾਉਣੇ ਅੱਜ ਪਰ ਅੱਜ ਕੱਲ੍ਹ ਦੇ ਮੁਖੀ ਪੰਚਾਇਤ ਦੇ ਮੁਖੀ ਜਾਂ ਫਿਰ ਨਗਰ ਪਾਲਿਕਾ ਦੇ ਮੁਖੀ ਇਹ ਕੰਮ ਨਾ ਕਰਕੇ ਸਿਰਫ ਆਪਣੀਆਂ ਕਮਾਈਆਂ ਆਪਣੀ ਪ੍ਰਗਤੀ ਵੱਲ ਧਿਆਨ ਦੇ ਰਹੇ ਨੇ ਇਸ ਕਰਕੇ ਅੱਜ ਕੱਲ੍ਹ ਦੇ ਪਿੰਡ ਅਤੇ ਨਗਰ ਪਾਲਿਕਾ ਦਿਨੋਂ ਦਿਨ ਇਹਨਾਂ ਦੀ ਹਾਲਤ ਬੱਤਰ ਹੋਈ ਜਾ ਰਹੀ ਹੈ